ਮੈਂ ਇੱਕ ਦਿਨ ਬ੍ਰੈਡ ਰੋਲ ਬਣਾ ਰਹੀ ਸੀਗੀ ਅਤੇ ਮੈਨੂੰ ਸੀਗਾ ਵੀ ਮੇਰੀ ਬੇਟੀ ਨੂੰ ਹੁੰਦਾ ਵੀ ਮੰਮਾ ਕੁਛ ਇਨੋਵੇਟਿਵ ਕਰੀਏ ਹੈਨਾ ਕੁਛ ਨਵਾਂ ਨਵੇਂ ਤਰੀਕੇ ਦੇ ਬ੍ਰੈਡ ਰੋਲ ਬਣਾਈਏ ਅਤੇ ਮੈਂ ਫਿਰ ਕੀ ਕੀਤਾ ਇੱਕ ਤਾਂ ਉਹਦੇ ਵਿੱਚ ਮੂੰਗਫਲੀ ਮੈਂ ਕਰਸ਼ ਕਰਕੇ ਪਾਈ ਬ੍ਰੈਡ ਰੋਲ ਦੇ ਵਿੱਚ ਅਤੇ ਮੈਂ ਇੱਕ ਉਹਦੇ ਵਿੱਚ ਜਿਹੜੀ ਮੈਨੀਜ਼ ਆ ਨਾ ਜਦੋਂ ਮੈਂ ਉਹਦਾ ਬੇਸ ਤਿਆਰ ਕੀਤਾ ਪੂਰਾ ਜਿਹੜਾ ਆਲੂ ਉਬਾਲ ਕੇ ਫਿਰ ਉਹਨਾਂ ਨੂੰ ਮੈਸ਼ ਕਰਕੇ ਮੈਂ ਉਹਦੇ ਵਿੱਚ ਥੋੜ੍ਹੇ ਪਿਆਜ਼ ਪਾਏ ਥੋੜ੍ਹੀ ਸ਼ਿਮਲਾ ਮਿਰਚ ਪਾਈ ਅਤੇ ਫਿਰ ਥੋੜ੍ਹਾ ਜਿਹਾ ਉਹਨੂੰ ਵੈਸਟਰਨ ਟਵਿਸਟ ਦੇਣ ਦੇ ਲਈ ਮੈਂ ਉਹਦੇ ਵਿੱਚ ਕੀ ਕੀਤਾ ਕਿ ਮੈਂ ਉਹਦੇ ਵਿੱਚ ਥੋੜ੍ਹੀ ਮੈਨੀਜ਼ ਪਾ ਤੀ ਅਤੇ ਥੋੜ੍ਹਾ ਜਿਹਾ ਚੀਜ਼ ਪਾਤਾ ਅਤੇ ਉਹ ਚੀਜ਼ ਦੇ ਨਾਲ ਪਾ ਕੇ ਫਿਰ ਮੈਂ ਉਹਨੂੰ ਬ੍ਰੈਡ ਦੇ ਵਿੱਚ ਰੋਲ ਕਰਕੇ ਜਦੋਂ ਮੈਂ ਉਹਨੂੰ ਫਰਾਈ ਕੀਤਾ ਹੈ ਨਾ ਅਤੇ ਜਦੋਂ ਮੇਰੀ ਬੇਟੀ ਨੇ ਓਪਨ ਖੋ ਖੋਲ੍ਹਿਆ ਉਹਨੂੰ ਤੋੜਿਆ ਅਤੇ ਉਹਦੇ ਵਿੱਚੋਂ ਪੂਰਾ ਚੀਜ਼ ਦੀ ਜਿਹੜੀ ਫੀਲਿੰਗ ਸੀ ਤਾਂ ਮੇਰੀ ਬੇਟੀ ਬਹੁਤ ਖੁਸ਼ ਸੀ ਵੀ ਮੰਮਾ ਨੇ ਇੰਡੀਅਨ ਜਿਹੜੀ ਚੀਜ਼ ਆ ਹੈ ਨਾ ਦੇਸ਼ੀ ਦੇਸੀ ਜਿਹੜੀ ਚੀਜ਼ ਆ ਉਹ ਵਿਦੇਸ਼ੀ ਤਰੀਕੇ ਦੇ ਨਾਲ ਬਣਾਈ ਹਾਂ